ਹੈਲੋ ਹੈਲੋ ਹਾਂਜੀ ਜੀ ਇੱਥੇ ਮੋਡਲ ਹੈ ਵੱਖਰੇ ਵੱਖਰੇ ਐੱਲ ਜੀ ਹਾਇਅਰ ਗੋਦਰੇਜ ਸੈਮਸੰਗ ਕਿਹੜਾ ਵਾਲਾ ਚਾਈਦਾ ਏ ਅੱਛਾ ਹਾਂਜੀ ਵੱਖਰੇ ਵੱਖਰੇ ਜੀ ਸਟਾਟਿੰਗ ਤਾਂ ਹੈਗੀ ਹੈ ਦਸ ਹਜਾਰ ਤੋਂ ਜੀ ਪੰਤਾਲੀ ਹਜਾਰ ਵਾਲਾ ਸਾਰਾ ਸਾਰਿਆਂ ਤੋਂ ਵਧੀਆ ਤੁਹਾਨੂੰ ਮਿਲ ਜਾਵੇਗਾ ਫੀਚਰਸ ਇਸ ਦੇ ਵਿੱਚ ਹੋਣਗੇ ਕੀ ਤੁਹਾਨੂੰ ਡਬਲ ਡੋਰ ਫਰਿੱਜ ਹੋਊਗਾ ਸਾਰਿਆਂ ਤੋਂ ਵੱਡਾ ਸਾਈਜ ਤੇ ਇਸ ਦੀ ਜਿਹੜੀ ਕੂਲਿੰਗ ਹੈ ਉਹ ਵੀ ਬਹੁਤ ਵਧੀਆ ਮਿਲੇਗੀ ਹੋ ਤੁਹਾਨੂੰ ਇਸ ਦੇ ਨਾਲ ਨਾਲ ਤੁਹਾਨੂੰ ਜੋ ਬਰਫ਼ ਜਮਾਣ ਵਾਲਾ ਵਾਲੀ ਟਰੇਅ ਹੈ ਉਹ ਫ੍ਰੀ ਹੈ ਵਿੱਚੇ ਤੇ ਬਰਫ਼ ਵੀ ਬਹੁਤ ਵਧੀਆ ਜੰਮੇਗੀ ਤੇ ਉਨ ਦੇ ਨਾਲ ਜਿਵੇਂ ਆਪਦੇ ਨੋਰਮਲ ਫਰਿੱਜ ਦੇ ਵਿੱਚ ਤਾਂ ਉੱਤੇ ਰੈਫ੍ਰਿਜਰੇਟਰ ਹੁੰਦਾ ਤੇ ਥੱਲੇ ਫਰਿੱਜ ਹੁੰਦੇ ਇਥੇ ਤੇ ਰੈਫ੍ਰਿਜਰੇਟਰ ਵੱਖਰਾ ਹੈ ਤੇ ਫਰਿੱਜ ਵੱਖਰਾ ਹੈ ਠੀਕ ਹੈ ਜੀ ਉਹ ਫੇਰ ਨਾ ਹਾਂਜੀ ਜੀ ਉਹ ਤੁਹਾਨੂੰ ਅਠਾਈ ਹਜਾਰ ਦਾ ਪਊਗਾ ਜੀ ਵੈਸੇ ਤਾਂ ਹੁਣ ਜਿਵੇਂ ਦੀਵਾਲੀ ਆਨ ਵਾਲੀ ਹੈ ਤਾਂ ਅਸੀਂ ਓਫਰ ਓਦੋਂ ਲਾਵਾਂਗੇ ਤਿੰਨ ਪਰਸੈਂਟ ਡਿਸਕਾਊਂਟ

ਜੀ ਵੋਸ਼ਿੰਗ ਮਸ਼ੀਨ ਤਾਂ ਬਹੁਤ ਹੀ ਵੱਡਾ ਜਿਹਾ ਬਰੈਂਡ ਹੋ ਗਿਆ ਅਸੀਂ ਤੁਹਾਨੂੰ ਨਾ ਇੱਕ ਹੀਟਰ ਦੇ ਸਕਦੇ ਆਂ ਕਿਉਂਕੀ ਹੁਣ ਸਰਦੀਆਂ ਆ ਰਹੀਆਂ ਨੇ ਤਾਂ ਕਸਟਮਰਸ ਦੀ ਡਿਮਾਂਡ ਹੀਟਰ 'ਤੇ ਵੀ ਹੁੰਦੀ ਹੈ ਹੀਟਰ ਤੁਹਾਨੂੰ ਫ੍ਰੀ ਮਿਲੇਗਾ ਬਿਲਕੁਲ ਹੀ ਫਰਿੱਜ ਦੇ ਨਾਲ ਫਰਿੱਜ ਪਏਗਾ ਤੁਹਾਨੂੰ ਬੇਸਿਕਲੀ ਛੱਬੀ ਹਜਾਰ ਸੱਤ ਸੌ ਰੁਪਏ ਦਾ ਐਡਰੈਸ ਕੀ ਹੈ ਜੀ ਤੁਹਾਡਾ ਠੀਕ ਹੈ ਤੇ ਐਨ ਦੇ ਪਰ ਨਾ ਅਸੀਂ ਟਰਾਂਸਫਰਕੇਸ਼ਨ ਚਾਰਜਸ ਲਵਾਂਗੇ ਹੰਡਰਡ ਰੁਪੀਸ ਹਾਂਜੀ ਔਨਲਾਈਨ ਸਈ ਪਏਗਾ ਗਊਸ਼ਾਲਾ ਰੋਡ 'ਤੇ ਇਲੈਕਟ੍ਰੋਨਿਕਸ ਕੀ ਸ਼ੋਪ ਹੈ ਊਧਰ ਆਪ ਸਰਚ ਕਰ ਲੈਨਾ ਏਕ ਬਹੁਤ ਈ ਬੜੀ ਇਲੈਕਟ੍ਰੋਨਿਕਸ ਕੀ ਸ਼ੋਪ ਹੈ ਹਮਾਰੀ ਠੀਕ ਹੈ ਜੀ ਵੈਲਕਮ